ਹਾਂਜੀ ਦ ਦਦਮੇਸ਼ ਟਰਾਂ ਟਰਾਂਸਪੋਰਟ ਏਜੰਸੀ ਜੀ ਹਾਂਜੀ ਮੈਂ ਦੋ ਦਿਨ ਪਹਿਲਾਂ ਇੱਕ ਕੈਬ ਬੁੱਕ ਕਰਵਾਈ ਸੀ ਤੁਹਾਡੇ ਕੋਲੋਂ ਅਤੇ ਉਹਦੇ ਹਿਸਾਬ ਨਾਲ ਜੋ ਆਪਣਾ ਕਿਰਾਇਆ ਨਿਰਧਾਰਿਤ ਹੋਇਆ ਸੀ ਅਤੇ ਉਸਦੇ ਹਿਸਾਬ ਨਾਲ ਹੀ ਮੈਂ ਤੁਹਾਡੇ ਡਰਾਈਵਰ ਨੂੰ ਪੇਮੈਂਟ ਕਰੀ ਸੀ ਪਰ ਉਹ ਡਰਾਈਵਰ ਮੈਤੋਂ ਜ਼ਿਆਦਾ ਪੈਸੇ ਮੰਗ ਰਿਹਾ ਤੁਹਾਡਾ ਅਤੇ ਮੈਂ ਉਸ ਤੋਂ ਜ਼ਿਆਦਾ ਪੈਸੇ ਨਹੀਂ ਦੇ ਸਕਦਾ ਜੋ ਆਪਣਾ ਕਿਰਾਇਆ ਨਿਰਧਾਰਿਤ ਹੋਇਆ ਉਸ ਦੇ ਹਿਸਾਬ ਨਾਲ ਹੀ ਮੈਂ ਪੇ ਕਰਾਂਗਾ ਪਰ ਤੁਹਾਡਾ ਡਰਾਈਵਰ ਮੈਤੋਂ ਜ਼ਿਆਦਾ ਪੈਸੇ ਮੰਗ ਰਿਹਾ ਇਹ ਪਤਾ ਨਹੀਂ ਕਿਉਂ ਤੁਹਾਡਾ ਡਰਾਈਵਰ ਜ਼ਿਆਦਾ ਪੈਸੇ ਕਿਉਂ ਮੰਗ ਰਿਹਾ ਮੈਨੂੰ ਇਹ ਗੱਲ ਪਤਾ ਨਹੀਂ ਤੁਸੀਂ ਇੱਧਰੋਂ ਫੋਨ 'ਤੇ ਗੱਲ ਕਰਕੇ ਉਹਨੂੰ ਪੁੱਛੋ ਪਰ ਮੈਂ ਜੋ ਕਿਰਾਇਆ ਨਿਰਧਾਰਿਤ ਹੋਇਆ ਆਪਣੇ ਵਿੱਚ ਜੋ ਗੱਲਬਾਤ ਹੋਈ ਸੀ ਜੋ ਕਿਰਾਇਆ ਆਪਣਾ ਫਾਈਨਲ ਹੋਇਆ ਸੀਗਾ ਮੈਂ ਸਿਰਫ ਉਹਦੀ ਹੀ ਪੈਮੇਂਟ ਕਰਾਂਗਾ ਪਰ ਤੁਹਾਡਾ ਡਰਾਈਵਰ ਜ਼ਿਆਦਾ ਪੈਸੇ ਮੰਗ ਰਿਹਾ ਤੁਸੀਂ ਉਹਦੇ ਨਾਲ ਗੱਲ ਕਰੋ ਅਤੇ ਇਸ ਮਸਲੇ ਨੂੰ ਹੱਲ ਕਰੋ